ਮੈਨੂੰ ਚੰਦਰ ਗ੍ਰਹਿਆਂ ਦੇ ਵਿੱਚ ਇਸਰੋ ਬਾਰੇ ਪਤਾ ਚੱਲਿਆ ਸੀ ਕਿ ਕਲਪਨਾ ਚਾਵਲਾ ਸੁਨੀਤਾ ਵਿਲਜੀਅਮ ਅਤੇ ਰਕੇਸ਼ ਸ਼ਰਮਾ ਬਾਰੇ ਵੀ ਉਹ ਚੰਦਰਮਾ 'ਤੇ ਪਹਿਲੇ ਭਾਰਤੀ ਨੇ ਜਿਹੜੇ ਗਏ ਨੇ ਉੱਥੇ ਕੁਛ ਦੇਰ ਰਹਿਣ ਤੋਂ ਬਾਅਦ ਉਹਨਾਂ ਜਦੋਂ ਵਾਪਸ ਆਏ ਤਾਂ ਪਤਾ ਲੱਗਿਆ ਕਿ ਜਿਹੜੇ ਜਹਾਜ਼ ਇੱਥੇ ਆ ਰਹੇ ਨੇ ਵਾਪਸ ਉਹ ਚੰ ਉਹਦੇ ਵਿੱਚ ਕਲਪਨਾ ਚਾਵਲਾ ਦਾ ਐਕਸੀਡੈਂਟ ਹੋ ਗਿਆ ਸੀ ਉਹ ਤੋਂ ਬਾਅਦ ਇਹ ਨਹੀਂ ਪਤਾ ਲੱਗਿਆ ਵੀ ਕੀ ਬਣਿਆ ਅਤੇ ਕੀ ਨਹੀਂ ਬਣਿਆ ਹੁਣ ਵੀ ਤਾਂ ਜਾਂਦੇ ਹੀ ਨਾ ਹੁਣ ਭਾਰਤ ਨੇ ਵੇਖੋ ਕਿੱਡਾ ਵੱਡੀ ਮਾਰ ਮਾਰਤੀ ਅਤੇ ਜ ਮੰਗਲ ਗ੍ਰਹਿ ਦੇ ਉੱਤੇ ਜਾ ਕੇ ਆਪਣਾ ਝੰਡਾ ਗੱਡਤਾ